ਸਾਡੇ ਪੰਜਾਬ ਦੇ ਵਿੱਚ ਮਿੱਤਲ ਮੌਲ ਲਕਸ਼ਮੀ ਸਿਨੇਮਾ ਮੰਜੂ ਮੰਜੂ ਸਿਨੇਮਾ ਅਤੇ ਬੌਕਸ ਔਫਿਸ ਇਹ ਸਿਨੇਮਾ ਹਨ ਜਿਨ੍ਹਾਂ ਦੀਆਂ ਸਹੂਲਤਾਂ ਬਹੁਤ ਵਧੀਆ ਹਨ ਅਤੇ ਜਦ ਵੀ ਸਾਨੂੰ ਕੋਈ ਪਿਕਚਰ ਦੇਖਣੀ ਹੁੰਦੀ ਹੈ ਤਾਂ ਅਸੀਂ ਔਨਲਾਈਨ ਟਿਕਟਾਂ ਮੋਬਾਇਲ 'ਤੇ ਕਰਵਾ ਸਕਦੇ ਹਾਂ ਜਿਨ੍ਹਾਂ ਦੀਆਂ ਸਹੂਲਤਾਂ ਸਾਨੂੰ ਬਹੁਤ ਵਧੀਆ ਲੱਗਦੀਆਂ ਹਨ ਅਤੇ ਬਹੁਤ ਹੀ ਸੌਖੇ ਤਰੀਕੇ ਨਾਲ ਟਿਕਟਾਂ ਬੁੱਕ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਪ੍ਰਾਈਜ਼ ਬਹੁਤ ਹੀ ਵਧੀਆ ਅਤੇ ਘੱਟ ਰੇਟ ਹੁੰਦਾ ਹੈ ਜ ਇਹਨਾਂ ਸਿਨੇਮਾ ਦੇ ਵਿੱਚ ਜਾ ਕੇ ਸਾਨੂੰ ਫਿਲਮ ਦੇਖਣ ਦਾ ਬਹੁਤ ਹੀ ਆਨੰਦ ਮਿਲਦਾ ਹੈ ਅਤੇ ਇਹ ਸਿਨੇਮਾ ਇਹ ਸਿਨੇਮਾ ਜੋ ਵੀ ਮਿੱਤਲ ਮੌਲ ਮੰਜੂ ਸਿਨੇਮਾ ਅਤੇ ਬੌਕਸ ਔਫਿਸ 'ਤੇ ਇਹ ਸਾਰੇ ਸਿਨੇਮਾ ਹਨ ਇਹ ਬਹੁਤ ਵਧੀਆ ਹਨ ਅਤੇ ਇਹਨਾਂ ਸਿਨੇਮਾ ਦੀਆਂ ਸਹੂਲਤਾਂ ਬਹੁਤ ਹੀ ਵਧੀਆ ਹਨ ਅਤੇ ਨਾ ਹੀ ਸਾਨੂੰ ਜ਼ਿਆਦਾ ਮਤਲਬ ਕਿ ਜਿਵੇਂ ਹ ਹੋਰ ਸਿਨੇਮਾ ਦੇ ਵਿੱਚ ਆਪਾਂ ਟਿਕਟਾਂ ਬੁੱਕ ਕਰਵਾਉਂਦੇ ਹਾਂ ਉਹਨਾਂ ਦੇ ਵਿੱਚ ਬਹੁਤ ਹੀ ਲੁੱਟ ਮੱਚੀ ਹੁੰਦੀ ਹੈ ਕਿਉਂਕਿ ਉਹ ਐਕਸਟਰਾ ਪੈਸੇ ਲੈ ਕੇ ਤੇ ਟਿਕਟਾਂ ਵੇਚਦੇ ਹਨ ਟਿਕਟਾਂ ਦਿੰਦੇ ਹਨ ਅਤੇ ਇਹ ਸਭ ਝੰਜਟ ਇਹ ਸਿਨੇਮਾ ਵਿੱਚ ਨਹੀਂ ਹੁੰਦਾ ਅਸੀਂ ਇਹ ਸਿਨੇਮਾ ਦੇਖਣ ਦੇ ਲਈ ਅਸੀਂ ਫੋਨ 'ਤੇ ਔਨਲਾਈਨ ਟਿਕਟਾਂ ਕਰਵਾ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਸਾਨੂੰ ਬੈਸਟ ਪ੍ਰਾਈਸ ਮਿਲਦਾ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਟਿਕਟਾਂ ਬੁੱਕ ਹੋ ਜਾਂਦੀਆਂ ਹਨ ਅਤੇ ਅਸੀਂ ਸਿਨੇਮਾ ਦੇ ਵਿੱਚ ਜਾ ਕੇ ਹਰ ਇੱਕ ਮੂਵੀ ਦਾ ਆਨੰਦ ਮਾਣਦੇ ਹਾਂ